ਮੈਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਰਹਿੰਦੀ ਹਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਕਈ ਕੋਲਜ ਹਨ ਜਿਨ੍ਹਾਂ ਵਿੱਚੋਂ ਮਸ਼ਹੂਰ ਕੋਲਜ ਬਾਬਾ ਬੰਦਾ ਸਿੰਘ ਬਹਾਦਰ ਇੰਜੀਨਰਿੰਗ ਕੋਲਜ ਮਾਤਾ ਗੁਜਰੀ ਕੋਲਜ ਦੇਸ਼ ਪਕ ਯੂਨੀਵਰਸਿਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਅਤੇ ਸੈਫਰਨ ਸਿਟੀ ਵਰਗੇ ਕਈ ਮਸ਼ਹੂਰ ਕੋਲਜਜ ਹਨ ਮੇਰੀ ਛੋਟੀ ਭੈਣ ਮਾਤਾ ਗੁਜਰੀ ਕੋਲਜ ਵਿੱਚ ਪੜ੍ਹਦੀ ਹੈ ਅਤੇ ਮੇਰਾ ਛੋਟਾ ਭਰਾ ਵੀ ਮਾਤਾ ਗੁਜਰੀ ਕੋਲਜ ਵਿੱਚ ਪੜ੍ਹਦਾ ਹੈ ਮੇਰੀ ਛੋਟੀ ਭੈਣ ਮਾਤਾ ਗੁਜਰੀ ਕੋਲਜ ਵਿੱਚ ਬੀ ਸੀ ਏ ਕਰ ਰਹੀ ਹੈ ਮੇਰਾ ਛੋਟਾ ਭਰਾ ਮਾਤਾ ਗੁਜਰੀ ਕੋਲਜ ਵਿੱਚ ਬੀ ਕੌਮ ਕਰ ਰਿਹਾ ਹੈ ਮਾਤਾ ਗੁਜਰੀ ਕੋਲਜ ਇੱਕ ਵਧੀਆ ਕੋਲਜ ਹੈ ਇਸਦੇ ਅਧਿਆਪਕ ਬਹੁਤ ਹੀ ਚੰਗੇ ਹਨ ਮਾਤਾ ਗੁਜਰੀ ਕੋਲਜ ਵਿੱਚ ਹੈ ਅਧਿਆਪਕ ਬਹੁਤ ਹੀ ਵਧੀਆ ਤਰੀਕੇ ਨਾਲ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ ਮਾਤਾ ਗੁਜਰੀ ਕੋਲਜ ਸਾਡੇ ਇਲਾਕੇ ਦਾ ਇੱਕ ਮਸ਼ਹੂਰ ਕੋਲਜ ਹੈ ਜਿਸ ਵਿੱਚ ਦੂਰੋਂ ਦੂਰੋਂ ਅਧਿਆਪਕ ਪੜ੍ਹਾਉਣ ਲਈ ਆਉਂਦੇ ਹਨ ਮਾਤਾ ਗੁਜਰੀ ਕੋਲਜ ਵਿੱਚ ਕਈ ਪ੍ਰਕਾਰ ਦੀਆਂ ਲੈਬਸ ਵੀ ਖੁੱਲ੍ਹੀਆਂ ਹੋਈਆਂ ਹਨ ਜਿਨ੍ਹਾਂ ਵਿੱਚ ਵਿਦਿਆਰਥੀ ਆਪਣੀ ਲੋੜ ਅਨੁਸਾਰ ਕੰਮ ਕਰ ਸਕਦੇ ਹਨ ਮਾਤਾ ਗੁਜਰੀ ਕੋਲਜ ਇੱਕ ਵਧੀਆ ਕੋਲਜ ਹੈ